ਕੇਵਲ ਸਾਡੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਪੂਰੇ ਪੂਰੇ ਦੁਨੀਆ ਵਿੱਚ ਕੋਈ ਨਾ ਕੋਈ ਬਹੁਤ ਹੀ ਪਰੇਸ਼ਾਨੀ ਆ ਰਹੀ ਹਨ ਜਿਸ ਦਾ ਕਾਰਨ ਆਪਾਂ ਖੁਦ ਇਨਸਾਨ ਹੀ ਹੈਗੇ ਹਨ ਜਿੱਦਾਂ ਆਪਾਂ ਗੱਲ ਕਰੀਏ ਵਾਟਰ ਸਪਾਰਸੀ ਮਤਲਬ ਪਾਣੀ ਦੀ ਕਮੀ ਪਾਣੀ ਦੀ ਕਮੀ ਸਾਡੇ ਦੇਸ਼ ਵਿੱਚ ਸਾਰੀ ਦੁਨੀਆ ਵਿੱਚ ਖਤਮ ਹੁੰਦੀ ਜਾ ਰਹੀ ਸਾਡੇ ਦੇਸ਼ ਵਿੱਚ ਪਾਣੀ ਦੀ ਕਮੀ ਬਹੁਤ ਜਿਆਦਾ ਵਧੀ ਜਾ ਰਹੀ ਹੈ ਅੱਗੇ ਵਾਲੀ ਪੀੜੀਆ ਨੂੰ ਪਾਣੀ ਨਸੀਬ ਹੋਣਾ ਬਹੁਤ ਹੀ ਮੁਸ਼ਕਿਲ ਹੋ ਸਕਦਾ ਹੈ ਇਸ ਕਾਰਨ ਸਾਨੂੰ ਬਹੁਤ ਸਾਰੇ ਕੰਮ ਕਰਨੇ ਪੈਣੇ ਹੈ ਸਾਨੂੰ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ ਜੇਕਰ ਪਾਣੀ ਲੁੜਦਾ ਪਿਆ ਤਾ ਉਹਨੂੰ ਬੰਦ ਕਰਨਾ ਚਾਹੀਦਾ ਹੈ ਪਾਣੀ ਨੂੰ ਬਚਾਣਾ ਚਾਹੀਦਾ ਹੈ ਸਾਨੂੰ ਪੇੜ ਨਹੀਂ ਕੱਟਣੇ ਚਾਹੀਦੇ ਹਨ ਸਾਨੂੰ ਪੇੜ ਜਿਆਦਾ ਲਗਾਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਸਾਹ ਮਿਲੇ ਲੋਕਾਂ ਨੂੰ ਆਕਸੀਜਨ ਮਿਲੇ ਲੋਕੀ ਅੱਛੀ ਤਰ੍ਹਾਂ ਨਾਲ ਜੀ ਸਕਣ ਇਸੇ ਪ੍ਰਕਾਰ ਸਭ ਤੋਂ ਵੱਡਾ ਸਭ ਤੋਂ ਵੱਡੀ ਅਗਰ ਆਪਾਂ ਕੋਈ ਕਹੀਏ ਪਰੇਸ਼ਾਨੀ ਹੈਗੀ ਹ ਤੇ ਉਹ ਹੈਗੀ ਆ ਸੋਇਲ ਡੀਗਰਡੇਸ਼ਨ ਦੀ ਇਸਦਾ ਮਤਲਬ ਇਹ ਹੈ ਕਿ ਜਿੱਦਾਂ ਵਾੜ ਆਉਂਦੀ ਹੈ ਜਾਂ ਕੁਛ ਵੀ ਚੀਜ ਹੁੰਦੀ ਹੈ ਤਾਂ ਸਾਡੇ ਜਿਹੜੇ ਉਪਰੀ ਭਾਗ ਦੀ ਮਿੱਟੀ ਹੁੰਦੀ ਹੈ ਜਿਹਚ ਸਾਰੇ ਪੌਸ਼ਟਿਕ ਨਿਊਟ੍ਰੀਅਨ ਹੁੰਦੇ ਉਹ ਸਾਰੇ ਉੱਡ ਜਾਂਦੇ ਹਨ ਜਿਸ ਕਾਰਨ ਫਸਲ 'ਚ ਕੋਈ ਵੀ ਨਿਊਟਰੀਐਂਟ ਵਧੀਆ ਨਹੀਂ ਆਉਂਦਾ ਹੈ ਤੇ ਲੋਕੀ ਬਿਮਾਰ ਪੈ ਰਹੇ ਹਨ ਕਿਉਂਕਿ ਲੋਕੀ ਅੱਜ ਕੱਲ ਵਿਗਿਆਨ ਵਿੱਚ ਇਹ ਆ ਗਿਆ ਹੈ ਕੀ ਲੋਕੀ ਇੰਜੈਕਸਨ ਲਗਾ ਕੇ ਬਹੁਤ ਜਿਆਦਾ ਫਲ ਉਗਾ ਰਹੇ ਹਨ ਸਬਜ਼ੀਆਂ ਉਗਾ ਰਹੇ ਹਨ ਜਿਸ ਦਾ ਪ੍ਰਭਾਵ ਸਾਡੇ ਵਿਅਕਤੀਗਤ ਜੀਵਨ ਵਿੱਚ ਪੈਂਦਾ ਤੇ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਹੈ ਸਾਨੂੰ ਪੂਰਾ ਚੰਗੇ ਤਰੀਕੇ ਨਾਲ ਖੇਤੀਬਾੜੀ ਕਰਨੀ ਚਾਹੀਦੀ ਹੈ ਸਾਨੂੰ ਕੂੜਾ ਕਰਕਟ ਇੱਕਦਮ ਕਚਰੇ ਡਸਟਬੀਨ ਵਿੱਚ ਸਿੱਟਣਾ ਚਾਹੀਦਾ ਹੈ ਕੂੜੇਦਾਨ ਵਿੱਚ ਸਿੱਟਣਾ ਚਾਹੀਦਾ ਹੈ ਇੱਧਰ ਉੱਧਰ ਨਹੀਂ ਸਿੱਟਣਾ ਚਾਹੀਦਾ